ਜੀ ਹਾਂ ਅੱਜ ਮੈਂ ਤੁਹਾਨੂੰ ਕੁਝ ਵੱਡੀਆਂ ਤਬਦੀਲੀਆਂ ਬਾਰੇ ਦੱਸਣ ਜਾ ਰਹੀ ਹਾਂ ਅੱਜ ਕੱਲ ਦੇ ਦੌਰ ਵਿੱਚ ਸਾਰੇ ਕੰਮ ਕੰਪਿਊਟਰਾਈਜ ਹੋ ਗਏ ਹਨ ਜਿਵੇਂ ਕਿ ਅੱਜ ਕੱਲ ਦੇ ਯੁੱਗ ਵਿੱਚ ਆਰਟੀਫਿਸ਼ਅਲ ਇੰਟੈਲੀਜੈਂਟਸ ਦਾ ਕੰਮ ਕੀਤਾ ਜਾਂਦਾ ਹੈ ਜ਼ਿਆਦਾਤਰ ਅੱਜ ਕੱਲ ਕੰਮ ਕੰਪਿਊਟਰਰਾਈਜ ਹੀ ਕੀਤੇ ਜਾਂਦੇ ਹਨ ਜਿਸ ਵਿੱਚ ਸਾਡੇ ਕੰਮ ਵਧੀਆ ਤਰੀਕੇ ਨਾਲ ਅਤੇ ਸੁਖਾਲੇ ਹੋ ਗਏ ਹਨ ਜਿਹਨਾਂ ਨਾਲ ਸਾਨੂੰ ਜਲਦੀ ਕੰਮ ਖਤਮ ਕੀਤਾ ਜਾ ਸਕਦਾ ਹੈ ਅਤੇ ਕੰਮ ਜਲਦੀ ਖਤਮ ਹੋ ਜਾਂਦਾ ਹੈ ਅਤੇ ਇਹ ਸੁਖਾਲਾ ਹੋ ਜਾਂਦਾ ਹੈ ਸਾਨੂੰ ਜ਼ਿਆਦਾ ਦੌੜਨਾ ਭੱਜਣਾ ਨਹੀਂ ਪੈਂਦਾ ਅੱਜ ਕੱਲ ਇਹ ਯੁੱਗ ਨਾਲ ਬਹੁਤ ਸਾਰੀਆਂ ਤਬਦੀਲੀਆਂ ਆਈਆਂ ਹਨ ਸਾਡੇ ਕੰਮ ਨੂੰ ਸੁਖਾਲਾ ਕਰ ਦਿੱਤਾ ਗਿਆ ਹੈ ਕੰਪਿਊਟਰ ਨੇ ਕੰਪਿਊਟਰ ਨਾਲ ਜਲਦੀ ਨਾਲ ਕੰਮ ਖਤਮ ਕਰ ਲਿਆ ਜਾਂਦਾ ਹੈ ਅਤੇ ਕੰਮ ਵਿੱਚ ਜ਼ਿਆਦਾ ਭੱਜ ਦੌੜ ਨਹੀ ਹੁੰਦੀ ਪਹਿਲਾਂ ਦੇ ਯੁੱਗ ਵਿੱਚ ਇਹ ਨਹੀਂ ਪਾਇਆ ਜਾਂਦਾ ਸੀ ਇਸ ਕਰਕੇ ਸਾਨੂੰ ਕੰਪਿਊਟਰਾਈਜ ਯੁੱਗ ਦਾ ਧੰਨਵਾਦ ਕਰਨਾ ਚਾਹੀਦਾ ਹੈ ਧੰਨਵਾਦ